ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਦਾ ਕੀ ਹਾਲ ਚਾਲ ਹੈ ਤੁਹਾਡੇ ਬਸ ਜੀ ਵਧੀਆ ਕੀ ਕਰ ਰਹੇ ਹੋ ਅੱਜ ਕੱਲ੍ਹ ਓਕੇ ਫਿਰ ਕਿੱਦਾਂ ਹੁਣ ਅੱਜ ਕੱਲ੍ਹ ਜਿਦਾਂ ਦਿਸੰਬਰ ਸੈਸ਼ਨ ਚੱਲ ਰਿਹਾ ਆ ਹੁਣ ਅਸੀਂ ਆਪਣੇ ਬੱਚਿਆਂ ਦੀਆਂ ਐਡਮਿਸ਼ਨ ਕਰਵਾਉਣੀਆਂ ਆ ਅਤੇ ਸਾਨੂੰ ਆਈ ਥਿੰਕ ਵਿਜਿਟ ਕਰਨਾ ਚਾਹੀਦਾ ਆ ਸਕੂਲ ਦੇ ਵਿੱਚ ਤੁਹਾਡਾ ਕੀ ਵਿਚਾਰ ਆ ਕਿਹੜੇ ਸਕੂਲ ਦੇ ਵਿੱਚ ਕਰ ਰਹੇ ਹੋ ਇੱਕ ਵਾਰ ਅਸੀਂ ਕਪੂਰਥਲਾ ਦੇ ਵਧੀਆ ਵਧੀਆ ਸਕੂਲਸ ਦੀ ਗੱਲ ਕਰੀਏ ਤਾਂ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਨੰਦ ਪਬਲਿਕ ਵੀ ਲਿਟਲ ਰੇਂਜਰ ਵੀ ਬਾਬਾ ਲਾਲਵਨੀ ਤਾਂ ਬਹੁਤ ਲਾਈਕ ਉਹਨਾਂ ਦਾ ਸਟੈਂਡਰਡ ਵੀ ਆਪਣੇ ਬਜਟ ਤੋਂ ਬਾਹਰ ਹੈ ਹੈ ਨਾ ਫੈਸਿਲਿਟੀਜ਼ ਵੀ ਕੁਛ ਉਹਨਾਂ ਦਾ ਲਈ ਐਟਮੋਸਫੇਅਰ ਸਹੀ ਨਹੀਂ ਹੈਗਾ ਵਾਤਾਵਰਨ ਹੈ ਨਾ ਅਤੇ ਇਸ ਕਰਕੇ ਅਸੀਂ ਕੋਈ ਜਿੱਥੇ ਸਾਡੇ ਬੱਚੇ ਪੰਜਾਬੀ ਵੀ ਸਿੱਖ ਸਕਣ ਨਾਲ ਨਾਲ ਵਧੀਆ ਵਧੀਆ ਮੈਨਰਜ ਸਿੱਖ ਸਕਣ ਹੈ ਨਾ ਸਾਨੂੰ ਮਤਲਬ ਇੱਦਾਂ ਦਾ ਕੋਈ ਵਧੀਆ ਸਕੂਲ ਦੇ ਵਿੱਚ ਸਾਨੂੰ ਜਾਣਾ ਚਾਹੀਦਾ ਆ ਜਿੱਥੇ ਸਾਡੇ ਬੱਚਿਆਂ ਦਾ ਭਵਿੱਖ ਬਣ ਸਕੇ ਅਤੇ ਫਿਰ ਆਪਾਂ ਨੂੰ ਅੱਛਾ ਅੱਛਾ ਹਾਂਜੀ ਓਕੇ ਓਕੇ ਓਕੇ ਓਕੇ ਇਦਾਂ ਦੀ ਇੱਦਾਂ ਦੀ ਫੈਸਿਲਿਟੀ ਆਈ ਥਿੰਕ ਆਨੰਦ ਪਬਲਿਕ ਵੀ ਨਹੀਂ ਹੈਗੀ ਆਈ ਥਿੰਕ ਉਹਦੇ ਵਿੱਚ ਵੀ ਨਹੀਂ ਹੈਗੀ ਪਰਾਈਸਿੰਗ ਦੇ ਵਿੱਚ ਵੀ ਨਹੀਂ ਹੈਗੀ ਆਈ ਥਿੰਕ ਲਿਟਲ ਏਂਜਲ ਵੀ ਨਹੀਂ ਆ ਹੈ ਨਾ ਮਤਲਬ ਇਹ ਚੀਜ਼ ਤਾਂ ਬਹੁਤ ਵਧੀਆ ਆ ਫਿਰ ਹੈ ਨਾ ਲਾਈਕ ਇੱਥੇ ਅਗਰ ਮੈਂ ਆਪਣੇ ਕਿ ਏ ਸੀ ਵੀ ਹਰ ਰੂਮ ਦੇ ਵਿੱਚ ਲੱਗਾ ਹੋਇਆ ਆ ਠੀਕ ਆ ਔਰ ਹਾਂ ਓਕੇ ਓਕੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਿਰ ਆਪਾਂ ਚੱਲੀਏ ਕਿਸੇ ਦਿਨ ਲਗਾ ਕੇ ਆਈਏ ਹੈ ਨਾ ਰਾਊਂਡ ਦੇਖਦੇ ਹਾਂ ਕਿਸੇ ਸਕੂਲ ਦੇ ਵਿੱਚ ਵਿਜਿਟ ਕਰਾਂਗੇ ਅਤੇ ਤਾਂ ਹੀ ਸਾਨੂੰ ਪਤਾ ਚੱਲੇਗਾ ਅਸੀਂ ਕਿਸ ਸਕੂਲ ਦੇ ਵਿੱਚ ਸੋਚ ਸਕਦੇ ਆਪਣੇ ਬੱਚਿਆਂ ਦਾ ਭਵਿੱਖ ਆਓ ਤੁਸੀਂ ਕਦੇ ਸਾਡੇ ਘਰ ਚਾਹ 'ਤੇ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵਧੀਆ ਹੈ ਨਾ ਇਹੋ ਜਿਹੀਆਂ ਗਤੀਵਿਧੀਆਂ ਦੇ ਵਿੱਚ ਬੱਚਿਆਂ ਦਾ ਭਾਗ ਲੈਣਾ ਵੀ ਬਹੁਤ ਜ਼ਰੂਰੀ ਆ ਪੜ੍ਹਾਈ ਇੱਕ ਅਲੱਗ ਵਿਸ਼ਾ ਮੰਨਿਆ ਜਾਂਦਾ ਆ ਅਤੇ ਬਟ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਇੱਦਾਂ ਦੀਆਂ ਸੇਵਾਵਾਂ ਇੱਦਾਂ ਦੀਆਂ ਗਤੀਵਿਧੀਆਂ ਵਿੱਚ ਵੀ ਭਾਗ ਲੈਣਾ ਬਹੁਤ ਜ਼ਰੂਰੀ ਹੈ ਠੀਕ ਹੈ ਚਲੋ ਕੋਈ ਨਹੀਂ ਤੁਸੀਂ ਆਓ ਹਾਂ ਆਓ ਤੁਸੀਂ ਘਰ ਕਿਸੇ ਦਿਨ ਚਾਹ ਪਾਣੀ 'ਤੇ ਚਲੋ ਠੀਕ ਐ ਜੀ ਓਕੇ ਬਾਏ ਬਾਏ